ਮੈਂ ਜੈਸਮੀਨ ਇਸਲਾਮਾਬਾਦ ਦੀ ਰਹਿਣ ਵਾਲੀ ਆਂ ਮੇਰਾ ਘਰ ਜਿਹੜਾ ਹੈ ਸਨਵੇਸ ਸਕੂਲ ਦੇ ਕੋਲ ਕੋਲ ਹੈ ਅਤੇ ਮੈਂ ਅੱਜ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਸਿਲੰਡਰ ਦੀ ਹੁਣ ਲੋੜ ਨਹੀਂ ਹੈ ਅਤੇ ਮੈਂ ਘਰੇ ਗੈਸ ਦੀ ਪਾਈਪਲਾਈਨ ਲਗਵਾ ਲਈ ਹੈ ਜਿਸ ਕਰਕੇ ਮੈਨੂੰ ਸਿਲੰਡਰ ਦੀ ਜ਼ਰੂਰਤ ਨਹੀਂ ਇਸ ਲਈ ਮੈਂ ਤੁਹਾਨੂੰ ਕਾਲ ਕਰ ਰਹੀ ਹਾਂ ਕਿ ਮੇਰਾ ਜਿਹੜਾ ਸਿਲੰਡਰ ਦੀ ਬੁਕਿੰਗ ਕਰਵਾਈ ਸੀ ਉਹਨਾਂ ਦਾ ਰੱਦ ਕੀਤਾ ਜਾਵੇ ਕਿਰਪਾ ਕਰਕੇ ਉਸਨੂੰ ਰੱਦ ਕਰਕੇ ਦਿੱਤਾ ਜਾਵੇ ਕਿਉਂਕਿ ਇਸ ਸਮੇਂ 'ਤੇ ਮੈਨੂੰ ਉਸਦੀ ਜ਼ਰੂਰਤ ਨਹੀਂ ਹੈ ਜਦੋਂ ਅੱਗੇ ਸਮੇਂ ਦੇ ਮੈਨੂੰ ਜ਼ਰੂਰਤ ਪਵੇਗੀ ਮੈਂ ਖੁਦ ਆਪਣੇ ਆਪ ਹੀ ਉਸਦੀ ਬੁਕਿੰਗ ਕਰਵਾ ਲਵਾਂਗੀ ਲੇਕਿਨ ਹੁਣ ਜਿਹੜੀ ਬੁਕਿੰਗ ਕਰਵਾਈ ਹੋਈ ਸੀਗੀ ਉਸਨੂੰ ਮੈਂ ਰੱਦ ਕਰਨਾ ਚਾਹੁੰਦੀ ਹਾਂ ਕਿਰਪਾ ਕਰਕੇ ਉਸਨੂੰ ਰੱਦ ਕਰ ਦਿੱਤਾ ਜਾਵੇ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਇਸ ਸਿਲੰਡਰ ਜਿਹੜਾ ਅਸੀਂ ਮੰਗਵਾਇਆ ਸੀਗਾ ਉਸ ਨੂੰ ਰੱਦ ਕੀਤਾ ਜਾਵੇ ਤਾਂ ਜੋ ਕਿ ਉਹ ਜਿਹੜਾ ਸਲੰਡਰ ਆ ਉਸਨੂੰ ਅਸੀਂ ਅਗਲੀ ਵਾਰ ਵਰਤ ਸਕੀਏ ਇਸ ਲਈ ਧੰਨਵਾਦ ਮੈਂ ਤੁਹਾਡੀ ਕਿਰਪਾ ਤੁਹਾਨੂੰ ਕਿਰਪਾ